ਗੀਤ ਗਾਣਾ ਅਤੇ ਸੁਣਨਾ ਮੈਨੂੰ ਬਚਪਨ ਤੋਂ ਹੀ ਬਹੁਤ ਪਸੰਦ ਹੈ ਸ਼ੁਰੂ ਤੋਂ ਮੈਂ ਆਪਣੇ ਸਕੂਲ ਦੇ ਵਿੱਚ ਪਹਿਲੇ ਤਾਂ ਮੈਂ ਪ੍ਰੇਅਰ ਸਭ ਤੋਂ ਅੱਗੇ ਮੈਂ ਬੋਲਦੀ ਸੀ ਪਿੱਛੋਂ ਸਾਰੇ ਬੱਚੇ ਬੋਲਦੇ ਸੀ ਮੇਰੀ ਆਵਾਜ਼ ਬਹੁਤ ਵਧੀਆ ਸੀ ਅਤੇ ਫਿਰ ਜਿਹੜੇ ਸਕੂਲ ਵਿੱਚ ਮਾਸਟਰ ਸੀ ਗੀਤ ਗਾਉਂਦੇ ਨੇ ਮਾਸਟਰ ਜੀ ਜਿਹੜੇ ਸੰਗੀਤ ਵਾਲੇ ਮਾਸਟਰ ਜੀ ਮੈਂ ਉਹਨਾਂ ਕੋਲੋਂ ਵੀ ਉਹ ਸਿੱਖਦੀ ਸੀ ਸਕੂਲ ਸਾਡੇ ਆਉਂਦੇ ਸੀ ਅਤੇ ਬਹੁਤ ਵਧੀਆ ਬੋਲਦੀ ਸੀ ਮੈਂ ਫਿਰ ਉਂਝ ਹੀ ਵੱਡੇ ਹੁੰਦਿਆਂ ਹੁੰਦਿਆਂ ਮੇਰਾ ਸੰਗੀਤ ਨਾਲ ਬਹੁਤ ਜ਼ਿਆਦਾ ਲਗਾਵ ਹੋ ਗਿਆ ਮੈਂ ਆਪਣੇ ਪਿਤਾ ਜੀ ਨੂੰ ਵੀ ਕਿਹਾ ਕਿ ਮੈਂ ਸੰਗੀਤ ਵਿੱਚ ਅੱਗੇ ਵਧਣਾ ਚਾਹੁੰਦੀ ਹਾਂ ਅਤੇ ਮੇਰੇ ਪਿਤਾ ਜੀ ਬਹੁਤ ਸਖਤ ਹੈਗੇ ਸੀ ਉਹਨਾਂ ਨੇ ਮੈਨੂੰ ਅੱਗੇ ਵਧਣ ਦੀ ਪ੍ਰੇਰਨਾ ਨਹੀਂ ਦਿੱਤੀ ਅਤੇ ਮੈਨੂੰ ਇਜਾਜ਼ਤ ਨਹੀਂ ਦਿੱਤੀ ਉਹਨਾਂ ਨੇ ਮੈਂ ਫਿਰ ਹੁਣ ਆਪਣੇ ਘਰ ਹੀ ਰੇਡੀਓ ਵਿੱਚ ਮੋਬਾਇਲ ਵਿੱਚ ਜਾਂ ਟੀਵੀ ਵਿੱਚ ਮੈਂ ਹਰ ਤਰ੍ਹਾਂ ਦੇ ਗਾਣੇ ਸੁਣਦੀ ਹਾਂ ਅਤੇ ਨਾਲ ਬੋਲਦੀ ਵੀ ਹਾਂ ਅਤੇ ਮੈਨੂੰ ਸਭ ਤੋਂ ਵਧੀਆ ਮਾਤਾ ਦੀਆਂ ਭੇਟਾਂ ਬਹੁਤ ਵਧੀਆ ਲੱਗਦੀਆਂ ਨੇ ਇੱਕ ਮਾਤਾ ਦੀ ਭੇਟ ਦਿਲ ਦੀਆਂ ਗੱਲਾਂ ਕਰਾਂ ਤੇਰੇ ਨਾਲ ਤੂੰ ਭਾਵੇਂ ਸਾਹਮਣੇ ਮੈ ਹੋ ਹਾਂ ਚਰਨਾਂ ਨਾਲ ਇਹ ਮੈਨੂੰ ਚੰਚਲ ਦੇ ਭੇਟਾਂ ਬਹੁਤ ਹੀ ਵਧੀਆ ਲੱਗਦੀਆਂ ਨੇ ਅਤੇ ਮੈਂ ਇਹ ਸਾਰੇ ਬਹੁਤ ਪਸੰਦ ਕਰਦੀ ਹਾਂ ਧੰਨਵਾਦ ਜੀ